ਬਚਪਨ ਦੀ ਦੇ ਵਿੱਚ ਜੋ ਯਾਤਰਾ ਕੀਤੀ ਮੈਂ ਆਪਣੇ ਮਾਂ ਬਾਪ ਨਾਲ ਕਰ ਕਰਦੇ ਹੁੰਦੇ ਸੀ ਨੈਣਾ ਦੇਵੀ ਜਾਇਆ ਕਰਦੇ ਹੁੰਦੇ ਸੀ ਸਾਡੇ ਪਿਤਾ ਜੀ ਤਾਂ ਪਿੰਡੋਂ ਬਸ ਫੜਨੀ ਸਰਹਿੰਦ ਫਤਿਹਗੜ੍ਹ ਸਾਹਿਬ ਇਥੋਂ ਬੱਸ ਬਦਲ ਕਰਕੇ ਸਿੱਧਾ ਅਨੰਦਪੁਰ ਸਾਹਿਬ ਪਹੁੰਚਣਾ ਅਨੰਦਪੁਰ ਸਾਹਿਬ ਮੱਥਾ ਆਪਣਾ ਟੇਕ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਵਗੈਰਾ ਛਕ ਕਰਕੇ ਪਹੁੰਚਣਾ ਕੌਲਾਂ ਵਾਲੇ ਟੋਭੇ ਪੈਦਲ ਯਾਤਰਾ ਹੁੰਦੀ ਸੀ ਉਦੋਂ ਹੁਣ ਤਾਂ ਸਾਧਨ ਬਹੁਤ ਨੇ ਰੋਪ ਵੇਅ ਅਲੱਗ ਅਲੱਗ ਹੈ ਰੋਡ ਅਲੱਗ ਬਣ ਗਿਆ ਅਤੇ ਪੈਦਲ ਯਾਤਰਾ ਜਾਣਾ ਅਸੀਂ ਕੌਲਾਂ ਵਾਲੇ ਟੋਭੇ ਕੌਲਾਂ ਵਾਲੇ ਟੋਭੇ ਤੋਂ ਪਹਾੜੀ ਰਸਤੇ ਰਾਹੀਂ ਚਲੋ ਚਾਲ ਚਲੋ ਚਾਲ ਮਾਤਾ ਦੇ ਮੰਦਰ 'ਤੇ ਪਹੁੰਚਣਾ ਉੱਥੇ ਰਸਤੇ ਦੇ ਵਿੱਚ ਜਿਊਣੇ ਮੋੜ ਦੀ ਜਗ੍ਹਾ ਆਉਂਦੀ ਸੀ ਉਹਦੇ ਵੀ ਦਰਸ਼ਨ ਕਰਨੇ ਚਲ ਮੰਦਰ 'ਚ ਮੱਥਾ ਟੇਕ ਕਰਕੇ ਨੀਚੇ ਆ ਕਰਕੇ ਕੌਲਾਂ ਵਾਲੇ ਟੋਭੇ ਰਾਹੀਂ ਆ ਕਰਕੇ ਅਨੰਦਪੁਰ ਸਾਹਿਬ ਫਿਰ ਸਟੇਅ ਕਰਨੀ ਫਿਰ ਅਨੰਦਪੁਰ ਸਾਹਿਬ ਜੋ ਗੁਰਦੁਆਰਾ ਸੀ ਸਾਰੇ ਉਹਨਾਂ ਦੇ ਦਰਸ਼ਨ ਕਰ ਕਰਾ ਕੇ ਆ ਜਾਣਾ ਜੀ ਆਪਣੇ ਕੀਰਤਪੁਰ ਸਾਹਿਬ ਕੀਰਤਪੁਰ ਸਾਹਿਬ ਦਰਸ਼ਨ ਕਰਨੇ ਓਦੂ ਬਾਅਦ ਪਿੰਡ ਆ ਜਾਣਾ ਅਤੇ ਮਾਤਾ ਪਿਤਾ ਤੋਂ ਬਿਨਾ ਪਿੰਡ ਆ ਕਰਕੇ ਫਿਰ ਆਪਣੇ ਮਿੱਤਰਾਂ ਦੋਸਤਾਂ ਨਾਲ ਸਾਈਕਲ 'ਤੇ ਹੀ ਕਈ ਵਾਰੀ ਸਾਈਕਲ ਏ ਹੱਕ ਲੈਣਾ ਸਾਡੇ ਜੇ ਕਿਤੇ ਜਗ੍ਹਾ ਹੁੰਦੀ ਸੀ ਉੱਥੇ ਕੋਈ ਧਾਰਮਿਕ ਪ੍ਰੋਗਰਾਮ ਹੋਣਾ ਉੱਥੇ ਚਲੇ ਜਾਣਾ ਇਹ ਵੀ ਯਾਤਰਾ 'ਚ ਆ ਗਿਆ ਜਿਵੇਂ ਜਦੋਂ ਹੁਣ ਵੀਹ ਤੀਹ ਪੱਚੀ ਕਿਲੋਮੀਟਰ ਸਾਈਕਲ 'ਤੇ ਜਾਣਾ ਉੱਥੇ ਕਿਸੇ ਪ੍ਰੋਗਰਾਮ ਵਿੱਚ ਜਾ ਕੇ ਸਿਰਕਤ ਕਰਨੀ ਉਹਨਾਂ ਦੇ ਤਾਂ ਇਹਦੀ ਯਾਤਰਾ ਹੀ ਗਿਣੀ ਜਾਊਗੀ ਜਾਣਾ ਸਾਈਕਲ 'ਤੇ ਗੁੜ ਗੁੜ ਕਰਵਾਉਂਦੇ ਆਪਣਾ ਉੱਥੇ ਜਾਣਾ ਬਚ ਵਿਚਾਰ ਸੁਣਨੇ ਸੰਤਾਂ ਦੇ ਲੰਗਰ ਪਾਣੀ ਛਕਣਾ ਮੁੜ ਕੇ ਆਪਣਾ ਸ਼ਾਮ ਨੂੰ ਫਿਰ ਘਰ ਆ ਜਾਣਾ ਇਹ ਸੀ ਆਪਣੇ ਬਚਪਨ ਦੀ ਯਾਤਰਾ